ਟਰੈਕਟਰ ਦੀਆਂ ਬਹੁਤ ਸਾਰੀਆਂ ਕਿਸਮਾਂ ਹੁੰਦੀਆਂ ਹਨ ਜਿਵੇਂ ਕਿ ਜੋਨਡੀਅਰ ਸਵਰਾਜ ਸੋਨਾਲੀਂਕਾ ਮਹਿੰਦਰਾ ਫੋਰਡ ਅਰਜਨ ਐੱਚ ਐੱਮ ਟੀ ਅਨਾਹਠ ਗਿਆਰਾਂ ਅਤੇ ਹਿੰਦੁਸਤਾਨ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਕਿਸਮਾਂ ਦੇ ਟਰੈਕਟਰ ਪਾਏ ਜਾਂਦੇ ਹਨ ਅਤੇ ਇਹਨਾਂ ਦਾ ਉਪਯੋਗ ਅਸੀਂ ਖੇਤੀਬਾੜੀ ਕਰਨ ਵਾਸਤੇ ਵੀ ਕਰਦੇ ਹਾਂ ਅਤੇ ਸਮਾਨ ਨੂੰ ਇੱਕ ਥਾਂ ਤੋਂ ਦੂਜੀ ਜਗ੍ਹਾ 'ਤੇ ਲਿਜਾਣ ਵਾਸਤੇ ਵੀ ਟਰੈਕਟਰ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਆਪਾਂ ਫ਼ਸਲਾਂ ਨੂੰ ਉਗਾਉਣ ਵਾਸਤੇ ਵੀ ਟਰੈਕਟਰ ਦੀ ਵਰਤੋਂ ਕਰਦੇ ਹਾਂ ਅਤੇ ਪੁਰਾਣੇ ਸਮਿਆਂ ਵਿੱਚ ਰਵਾਇਤੀ ਢੰਗਾਂ ਨਾਲ ਵਰਤੋਂ ਕੀਤੀ ਜਾਂਦੀ ਸੀ ਪਰ ਹੁਣ ਪੁਰਾਣੇ ਯੁੱਗ ਵਿੱਚ ਹਲਾਂ ਪੰਜਾਲੀਆਂ ਦੀ ਵਰਤੋਂ ਕੀਤੀ ਜਾਂਦੀ ਸੀ ਉਹਨਾਂ ਨਾਲ ਹੀ ਆਪਾਂ ਖੇਤੀਬਾੜੀ ਕਰਦੇ ਸੀ ਅਤੇ ਹੁਣ ਨਵੇਂ ਯੁੱਗ ਵਿੱਚ ਟਰੈਕਟਰ ਦੀ ਟਕਨੀਕ ਆ ਗਈ ਹੈ ਅਸੀਂ ਟਰੈਕਟਰ ਦੀ ਵਰਤੋਂ ਖੇਤੀਬਾੜੀ ਲਈ ਹੁਣ ਕਰਦੇ ਹਾਂ